ਮੈਨੂੰ ਚਾਰ ਬਾਇਕਸ ਪਸੰਦ ਨੇ ਹਾਰਲੇ ਏਟ ਏਟ ਥਰੀ ਉਣੰਜਾ ਐਚ ਟੂ ਆਰ ਅਤੇ ਹਾਰਲੇ ਫੈਟ ਬੋਏ ਅਤੇ ਬੁਲਟ ਥਰੀ ਫਿਫਟੀ ਅਤੇ ਇਹ ਬਾਈਕਸ ਬਹੁਤ ਚੰਗੀਆਂ ਨੇ ਅਤੇ ਬਹੁਤ ਕੰਫਰਟੇਬਲ ਨੇ ਅਤੇ ਅਤੇ ਇਹ ਬਹੁਤ ਭਾਵੇਂ ਮਹਿੰਗੀਆਂ ਨੇ ਪਰ ਇਹ ਦਿਖਣ ਵਿੱਚ ਬਹੁਤ ਵਧੀਆ ਲੱਗਦੀਆਂ ਨੇ ਅਤੇ ਇਹ ਹਰੇਕ ਨੂੰ ਅਟਰੈਕਟ ਕਰਦੀਆਂ ਨੇ ਅਤੇ ਮੇਰੇ ਕੋਲ ਬੁੱਲਟ ਥਰੀ ਫਿਫਟੀ ਹੈ ਜਿਸਦੀ ਐਵਰੇਜ ਵੀ ਬਹੁਤ ਚੰਗੀ ਹੈ ਅਤੇ ਉਹ ਬਹੁਤ ਜਮ ਕੇ ਚੱਲਦੀ ਹੈ ਅਤੇ ਉਹ ਬਹੁਤ ਭਾਰੀ ਬਾਈਕ ਹੈ ਅਤੇ ਉਹ ਬਹੁਤ ਤੇਜ਼ ਰਫਤਾਰ ਨਾਲ ਚੱਲਦੀ ਹੈ ਅਤੇ ਅਤੇ ਉਹ ਅਤੇ ਉਸ ਵਿੱਚ ਬਹੁਤ ਹੀ ਬੜਾ ਇੰਜਣ ਲੱਗਿਆ ਹੋਇਆ ਹੈ ਜਿਸ ਕਾਰਨ ਉਸਦੀ ਪਕੜ ਵੀ ਬਹੁਤ ਮਜਬੂਤ ਹੈ ਅਤੇ ਜ ਅਤੇ ਜੇ ਮੈਂ ਕਿਤੇ ਵੀ ਧਾਰਮਿਕ ਸਥਾਨ 'ਤੇ ਜਾਣਾ ਹੋਵੇ ਤਾਂ ਮੈਂ ਹਿਮਾਲੀਅਨ ਨੂੰ ਲੈ ਕੇ ਜਾਊਂਗਾ ਕਿਉਂਕਿ ਉਹ ਹਰੇਕ ਇਹ ਟੂਰਿਸਟ ਬਾਈਕ ਬਣੀ ਹੈ ਅਤੇ ਉਹ ਇਸ ਲ ਕੰਮ ਲਈ ਉਹ ਬਣੀ ਹੋਈ ਹੈ ਜੇ ਉਹਨੂੰ ਕਿਤੇ ਵੀ ਲੈ ਕੇ ਜਾਣਾ ਹੋਵੇ ਤਾਂ ਉਹ ਆਸਾਨੀ ਨਾਲ ਚਲੀ ਜਾਂਦੀ ਹੈ ਕਿਉਂਕਿ ਉਸਦੀ ਐਵਰੇਜ ਵੀ ਜ਼ਿਆਦਾ ਹੈ ਅਤੇ ਉਹ ਬਹੁਤ ਹੀ ਇੱਕ ਹਲਕੀ ਬਾਈਕ ਹੈ ਅਤੇ ਉਹ ਬਹੁਤ ਜਮ ਕੇ ਚੱਲਦੀ ਹੈ ਅਤੇ ਉਹ ਪ੍ਰਾਈਜ਼ ਵਿੱਚ ਵੀ ਬਹੁਤ ਸਸਤੀ ਹੈ ਅਤੇ ਮੈਂ ਫਿਊਚਰ ਵਿੱਚ ਹਾਰਲੇ ਫੈਟ ਬੋੋਏ ਲੈਣੀ ਹੈ ਉਹ ਕੀ ਇੱਕੀ ਲੱਖ ਰੁਪਏ ਦੀ ਹੈ ਪਰ ਮੈਂ ਉਸ ਨੂੰ ਲੈ ਲਵਾਂਗਾ ਕਿਉਂਕਿ ਉਹ ਬਹੁਤ ਹੀ ਇਕ ਚੰਗੀ ਬਾਈਕ ਹੈ ਅਤੇ ਉਹ ਬਹੁਤ ਅਟਰੈਕਟਿਵ ਬਾਈਕ ਹੈ ਅਤੇ ਉਹ ਬਹੁਤ ਭਾਰੀ ਹੈ ਅਤੇ ਉਹਦੀ ਆਵਾਜ਼ ਬਹੁਤ ਜ਼ਿਆਦਾ ਹੈ ਤੇ ਜਿਸ ਕਾਰਨ ਉਹ ਮੈਨੂੰ ਬਹੁਤ ਚੰਗੀ ਲੱਗਦੀ ਹੈ